ਮੇਰੀ ਹੁਣ ਤੱਕ ਦੀ ਸਭ ਤੋਂ ਚਣੌਤੀਪੂਰਨ ਹਾਈਕਸ ਦ ਮੈਂ ਹਾਲੇ ਤਰਉਂਡ ਟਰੈਕ ਹੀ ਰਹੀ ਹੈ ਕਿਉਂਕਿ ਉਹ ਇਸ ਤੋਂ ਇਲਾਵਾ ਮੈਂ ਕੁਛ ਹੋਰ ਹਾਈਕਿੰਗ ਕੀਤੀ ਨਹੀਂ ਬਟ ਮੇਰਾ ਪਰ ਮੇਰਾ ਬਹੁਤ ਸ਼ੌਕ ਹੈ ਕਿ ਮੈਂ ਹੋਰ ਹਾਈਕਿੰਗ ਵੀ ਕਰਾਂ ਅਤੇ ਉੱਚੀਆਂ ਚੜ੍ਹਾਈਆਂ ਚੜ੍ਹਾ ਭਾਰਤ ਵਿੱਚ ਕਈ ਮਸ਼ਹੂਰ ਟਰੈਕ ਹਨ ਅਤੇ ਭਾਰਤ ਵਿੱਚ ਬਹੁਤ ਲੋਕ ਇਸ ਚੀਜ਼ ਦੇ ਸ਼ੌਕੀਨ ਹਨ ਅਤੇ ਉਹ ਹਮੇਸ਼ਾ ਕੁਛ ਨਵੀਂ ਜਾਣਕਾਰੀ ਹੀ ਦਿੰਦੇ ਹਨ ਭਾਰਤ ਵਿੱਚ ਪ੍ਰਸਿੱਧ ਹਾਈਕਿੰਗ ਟਰੈਕਸ ਨੇ ਜਿਵੇਂ ਕਿ ਜਿੱਦਾਂ ਕਸ਼ਮੀਰ ਗ੍ਰੇਟ ਲੇਕਸ ਟਰੈਕ ਖੀਰ ਗੰਗਾ ਟਰੈਕ ਅਤੇ ਟਰਿਉਨ ਟਰੈਕ ਉਹਨਾਂ 'ਚੋਂ ਇੱਕ ਹੈ ਹਮਟਾ ਪਾਸ ਟਰੈਕ ਅਨਾ ਪੁਰਨਾ ਬੇਸ ਕੈਂਪ ਅਤੇ ਇਸ ਤਰ੍ਹਾਂ ਦੇ ਕਈ ਹਾਈਕਿੰਗ ਪੁਆਇੰਟਸ ਨੇ ਜੋ ਕਿ ਭਾਰਤ ਵਿੱਚ ਮਸ਼ਹੂਰ ਹਨ ਇਸ ਲਈ ਵਾਧੂ ਜਾਣਕਾਰੀ ਲਈ ਅਸੀਂ ਯੂਟੀਊਬ ਜਾਂ ਨੈੱਟ ਦਾ ਸਹਾਰਾ ਲੈ ਸਕਦੇ ਹਾਂ